ਟੈਕਨੋਲਜੀ ਸਾਡੇ ਕਾਰੋਬਾਰ ਨੂੰ ਬਹੁਤ ਚੇਂਜ ਕਰ ਰਹੀ ਹੈ ਲੈਣ ਦੇਣ ਨੂੰ ਵੀ ਚੇਂਜ ਕਰ ਰਹੀ ਹੈ ਪਹਿਲਾਂ ਅਸੀਂ ਗੱਲ ਕਰਦੇ ਹਾਂ ਵੀ ਕਾਰੋਬਾਰ ਨੂੰ ਕਿਵੇਂ ਚੇਂਜ ਕਰਦੀ ਹੈ ਕਾਰੋਬਾਰ ਨੂੰ ਇਹ ਐਵੇਂ ਚੇਂਜ ਕਰਦੀ ਹੈ ਕਿ ਆਪਾਂ ਕੋਈ ਵੀ ਕੰਮ ਕਰਨਾ ਉਹ ਕੰਪਿਊਟਰ 'ਤੇ ਬਹੁਤ ਈਜਲੀ ਹੋ ਜਾਂਦਾ ਕੰਪਿਊਟਰ 'ਤੇ ਕਰ ਸਕਦੇ ਹਾਂ ਲੈਪਟੋਪ 'ਤੇ ਕਰ ਸਕਦੇ ਹਾਂ ਇਹਦੇ ਨਾਲ ਅਸੀਂ ਜਿਵੇਂ ਆਪਾਂ ਦੇਖਦੇ ਹਾਂ ਪਹਿਲਾਂ ਬੱਸ ਦੀ ਟਿਕਟ ਹੋ ਗਈ ਜਾਂ ਰੇਲਵੇ ਸਟੇਸ਼ਨ 'ਤੇ ਟਰੇਨਸ ਦੀ ਟਿਕਟ ਹੋ ਗਈ ਤਾਂ ਉਹ ਸਾਰਾ ਕੁਛ ਆਪਾਂ ਕੰਪਿਊਟਰ ਰਾਹੀਂ ਔਨਲਾਈਨ ਕਰਦੇ ਹਾਂ ਬੁੱਕ ਕਰਦੇ ਹਾਂ ਆਪਣੀ ਅਪੋਇੰਟਮੈਂਟ ਕਰਦੇ ਹਾਂ ਤਾਂ ਉਹਦੇ ਨਾਲ ਸਾਨੂੰ ਬਹੁਤ ਈਜੀ ਹੋ ਜਾਂਦਾ ਸਾਨੂੰ ਕਿਤੇ ਜਾਣਾ ਨਹੀਂ ਪੈਂਦਾ ਅਸੀਂ ਘਰ ਬੈਠ ਕੇ ਕਰ ਸਕਦੇ ਹਾਂ ਫਿਰ ਆਪਾਂ ਲੈਣ ਲੈਣ ਦੇਣ ਦੀ ਗੱਲ ਕਰੀਏ ਤਾਂ ਉਹ ਹੈ ਵੀ ਅਸੀਂ ਕੋਈ ਵੀ ਕਿਤੇ ਜਾਂਦੇ ਹਾਂ ਤਾਂ ਉੱਥੇ ਆਪਾਂ ਪੇਮੈਂਟ ਜਿਹੜੀ ਕੀ ਹੈ ਔਨਲਾਈਨ ਕਰਦੇ ਹਾਂ ਔਨਲਾਈਨ ਪੇਮੈਂਟ ਆਪਾਂ ਗੂਗਲ ਪੇ ਰਾਹੀਂ ਪੇਟੀਐੱਮ ਦੁਆਰਾ ਵੀ ਕਰ ਸਕਦੇ ਹਾਂ ਜਿਹੜਾ ਕਿ ਸਾਡੇ ਲਈ ਈਜੀ ਹੁੰਦਾ ਹੈ ਵੀ ਕਈ ਵਾਰ ਲੋਕਾਂ ਨੂੰ ਦਿੱਕਤ ਆਉਂਦੀ ਹੈ ਪੈਸੇ ਖੁੱਲ੍ਹੇ ਵਾਪਸ ਕਰਨ ਲੱਗੇ ਜਿਹਦੇ ਨਾਲ ਪੇਟੀਐੱਮ ਵਗੈਰਾ ਰਾਹੀਂ ਇਹ ਦਿੱਕਤ ਨਹੀਂ ਆਉਂਦੀ ਅਤੇ ਸਾਨੂੰ ਇਜੀ ਹੋ ਜਾਂਦਾ ਹੈ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਜਿਹੜੀ ਟੈਕਨੋਲਜੀ ਹੈ ਉਹ ਕਾਰੋਬਾਰ ਨੂੰ ਵੀ ਚੇਂਜ ਕਰ ਰਹੀ ਹੈ ਅਤੇ ਜਿਹੜਾ ਆਪਾਂ ਲੈਣ ਦੇਣ ਕਰਨਾ ਹੁੰਦਾ ਲੋਕਾਂ ਤੋਂ ਉਹ ਵੀ ਚੇਂਜ ਕਰ ਰਹੀ ਹੈ